ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸਣਾ ਚਾਹਵਾਂਗੀ ਕਿ ਜ਼ਿੰਦਗੀ ਵਿੱਚ ਖੇਡਾਂ ਕਿਉਂ ਜ਼ਰੂਰੀ ਹਨ ਅਤੇ ਇਸ ਉੱਤੇ ਆਪਣੇ ਵਿਚਾਰ ਸਾਂਝੇ ਕਰਨੇ ਚਾਵਾਂਗੀ ਸਾਡੀ ਜ਼ਿੰਦਗੀ ਵਿੱਚ ਖੇਡਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹਨ ਕਿਉਂਕਿ ਇਸ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਇਸ ਨਾਲ ਅਸੀਂ ਤਰੋ ਤਾਜ਼ਾ ਰਹਿੰਦੇ ਹਾਂ ਅਤੇ ਸਾਡੇ ਮੁੱਖ ਉੱਤੇ ਸਾਰਾ ਦਿਨ ਖੁਸ਼ਹਾਲੀ ਰਹਿੰਦੀ ਹੈ ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਅਤੇ ਸਾਡੇ ਸਰੀਰ ਵਿੱਚ ਮੋਟਾਪਾ ਨਹੀਂ ਆਉਂਦਾ ਇਸ ਨਾਲ ਸਾਡੇ ਕਈ ਤਰ੍ਹਾਂ ਦੇ ਗੁਣਾਂ ਵਿੱਚ ਵਿਕਾਸ ਹੁੰਦਾ ਹੈ ਜਿਸ ਤਰ੍ਹਾਂ ਭਾਰਤ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਹਨ ਜਿੱਦਾਂ ਸਰਕਾਰ ਨੂੰ ਇਸ ਉੱਤੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਇਸ ਲਈ ਲੋਕ ਆ ਕੇ ਇਸ ਵਿੱਚ ਮੁਕਾਬਲੇ ਵਿੱਚ ਹਿੱਸਾ ਲੈਣਗੇ ਅਤੇ ਖੇਡਾਂ ਨੂੰ ਵੱਧ ਚੜ੍ਹ ਕੇ ਖੇਡਣਗੇ ਇੱਕ ਤਰ੍ਹਾਂ ਨੂੰ ਜਿੱਤਣ ਦੇ ਲਈ ਹਰੇਕ ਆਪਣੀ ਚੰਗੀ ਖੇਡ ਦਿਖਾਵੇਗਾ ਜਿਸ ਨਾਲ ਲੋਕ ਖੇਡ ਵੀ ਖੇਡਣਗੇ ਅਤੇ ਉਹਨਾਂ ਲਈ ਮੁਕਾਬਲਾ ਵੀ ਚੰਗਾ ਹੋ ਜਾਵੇਗਾ ਅਤੇ ਮੇਰਾ ਇਹ ਹੀ ਹੋ ਵਿਚਾਰ ਹੈ ਕਿ ਖੇਡਾਂ ਸਾਡੇ ਜੀਵਨ ਲਈ ਬਹੁਤ ਜਰੂਰੀ ਹਨ ਅਤੇ ਸਾਨੂੰ ਖੇਡਣੀਆਂ ਚਾਹੀਦੀਆਂ ਹਨ ਖੇਡਾਂ ਨਾਲ ਅਸੀਂ ਤਰੋ ਤਾਜ਼ਾ ਰਹਿੰਦੇ ਹਾਂ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਖੇਡ ਕੇ ਭੱਜ ਕੇ ਕਰਨੀ ਚਾਹੀਦੀ ਹੈ ਧੰਨਵਾਦ